ਕੀ ਹਾਲ ਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਜੀ ਤੁਸੀਂ ਦੇਖੋ ਪਹਿਲਾਂ ਤਾਂ ਨਾਭੇ ਬੱਸ ਚੜੋਗੇ ਨਾਭੇ ਬੱਸ ਚੜ ਕੇ ਪਟਿਆਲਾ ਗੇਟ ਆਉਂਦਾ ਤੁਸੀਂ ਬੱਸ ਸਟੈਂਡ ਤੋਂ ਬੱਸ ਚੜੋਗੇ ਟਾਈਮ ਸਿਰ ਬੱਸ ਚੜ ਜਾਓ ਸੱਤ ਵਜੇ ਤੋਂ ਲੈ ਕੇ ਸਾਢੇ ਸੱਤ ਵਜੇ ਦੇ ਵਿੱਚ ਵਿੱਚ ਬੱਸ ਚੜ ਜਾਓ ਤਾਂ ਭੀੜ ਘੱਟ ਹੁੰਦੀ ਆ ਹਾਂ ਹਾਂਜੀ ਹਾਂਜੀ ਹਾਂਜੀ ਟਾਈਮ ਸਿਰ ਨਿਕਲ ਲਓਗੇ ਟਾਈਮ ਸਿਰ ਪਹੁੰਚ ਜਾਓਗੇ ਨਹੀਂ ਅੱਗੇ ਬੱਸ ਬਹੁਤ ਤੰਗ ਕਰਦੀ ਆ ਅਤੇ ਦੇਖੋ ਉਸ ਤੋਂ ਬਾਅਦ ਤੁਸੀਂ ਬੱਸ ਬੈਠੋਗੇ ਤੁਹਾਨੂੰ ਬੱਸ ਅੱਧੇ ਘੰਟੇ ਦੇ ਅੰਦਰ ਅੰਦਰ ਪਟਿਆਲੇ ਪਹੁੰਚਾ ਦਊਗੀ ਜਦੋਂ ਪਟ ਅੱਧੇ ਘੰਟੇ ਦੇ ਅੰਦਰ ਪਟਿਆਲੇ ਪਹੁੰਚ ਗਏ ਤੁਹਾਡੇ ਚੋਂ ਇੱਕ ਜਾਣੇ ਨੂੰ ਤੁਸੀਂ ਕਿਹੋ ਬੱਸ ਚੋਂ ਉਤਰ ਜੋ ਥਾਪਰ ਹਾਂਜੀ ਥਾਪਰ ਉਤਰ ਗਏ ਤੁਸੀਂ ਥਾਪਰ ਉਤਰ ਕੇ ਫੜਿਓ ਓਟੋ ਓਟੋ ਫੜ ਕੇ ਤੁਹਾਡੇ ਵੀਹ ਰੁਪਏ ਲੱਗਣਗੇ ਕੇ ਲੋਕਲ ਸਵਾਰੀ ਆ ਲੋਕਲ ਕਿਰਾਇਆ ਵੀਹ ਰੁਪਏ ਲੱਗਦਾ ਬੱਸ ਬੱਸ ਫਿਰ ਤੁਸੀਂ ਕਹਿ ਦਿਓ ਵੀ ਵੀਹ ਕੇ ਦੇਣੇ ਹੈ ਨਹੀਂ ਉਤਰ ਜਾਇਓ ਤੁਸੀਂ ਉਹ ਚੋਂ ਵੀ ਅਸੀਂ ਨਹੀਂ ਦਿੰਦੇ ਹੈਗੇ ਅਤੇ ਲੋਕਲ ਕਿਰਾਇਆ ਤੁਹਾਡਾ ਵੀਹ ਰੁਪਏ ਤੁਸੀਂ ਤਾਂ ਇੱਥੋਂ ਸਿੱਧਾ ਜਾਇਓ ਫਿਰ ਫੁਆਰਾ ਚੌਂਕ ਲੈ ਕੇ ਜਾਊਗਾ ਤੁਹਾਨੂੰ ਫੁਆਰਾ ਚੌਂਕ ਤੋਂ ਹੋ ਜਾਇਓ ਤੁਸੀਂ ਅੰਦਰ ਨੂੰ ਪੀ ਪੋਲੋ ਗਰਾਊਂਡ ਵੱਲ ਨੂੰ ਬੱਸ ਪੋਲੋ ਗਰਾਊਂਡ ਜਾਣ ਤੋਂ ਬਾਅਦ ਤੁਸੀਂ ਆ ਜਾਇਓ ਪੋਲੋ ਉੱਥੇ ਨਾਲ ਏ ਗੁਰਦੁਆਰਾ ਉੱਥੇ ਉਤਰ ਜੇ ਨਾਲ ਏ ਉਹ ਹੈ ਤੁਹਾਡੀ ਯੂਨੀਵਸਟੀ ਆ ਅਤੇ ਉਹ ਤੋਂ ਨਾ ਉਤਰ ਕੇ ਤੁਹਾਡਾ ਨਾਲ ਦੀ ਨਾਲ ਉਹ ਮਤਲਬ ਪਹੁੰਚ ਜਾਓਗੇ ਤੁਸੀਂ ਉੱਥੇ ਹਾਂਜੀ ਅਤੇ ਯੂਨੀਵਸਟੀ ਜਾਣ ਲਈ ਤੁਸੀਂ ਦੇਖੋ ਇਥੋਂ ਸਿੱਧੀ ਬੱਸ ਬੈਠਣਾ ਅਤੇ ਬੱਸ ਚੋਂ ਉਤਰਿਓ ਨਾ ਅਤੇ ਬੱਸ ਚੋਂ ਉਤਰਿਓ ਨਾ ਅਤੇ ਆਪਣਾ ਚੱਲੀ ਚੱਲਿਓ ਚੱਲੀ ਚੱਲਿਓ ਚੱਲੀ ਚੱਲਿਓ ਬੱਸ ਤੁਹਾਨੂੰ ਲੈ ਜਾਉਗੀ ਓ ਉੱਥੇ ਬੱਸ ਸਟੈਂਡ ਬੱਸ ਸਟੈਂਡ ਤੁਸੀਂ ਪਹੁੰਚ ਕੇ ਕੀ ਕਰਨਾ ਅਤੇ ਉੱਥੇ ਉਤਰ ਜਾਇਓ ਬੱਸ ਸਟੈਂਡ ਉੱਥੇ ਜਾਂ ਤਾਂ ਫੜ ਲਿਓ ਓਟੋ ਅਤੇ ਜਾਂ ਤਾਂ ਓਟੋ ਫੜ ਲਿਓ ਜਾਂ ਤੁਸੀਂ ਇੱਕ ਕੰਮ ਲਿਓ ਯੂਨੀਵਸਟੀ ਵਾਲੀ ਬੱਸ ਦਾ ਵੇਟ ਕਰ ਲਿਓ ਯੂਨੀਵਸਟੀ ਵਾਲੀ ਬੱਸ ਚਲਦੀ ਆ ਮਤਲਬ ਤਿੰਨ ਟਾਈਮ ਚੱਲਦੀ ਆ ਉਹ ਸਵੇਰੇ ਸਾਢੇ ਸੱਤ ਵਜੇ ਅਤੇ ਇੱਕ ਅੱਠ ਵਜੇ ਅਤੇ ਇੱਕ ਪੌਣੇ ਕੁ ਅੱਠ ਵਜੇ ਚੱਲਦੀ ਆ ਉਹ ਇੱਕ ਬੱਸ ਸਾਰੇ ਪਟਿਆਲੇ ਦਾ ਗੇੜਾ ਲਾਉਂਦੀ ਹੈ ਇੱਕ ਬੱਸ ਬੱਸ ਸਟੈਂਡ ਆਉਂਦੀ ਆ ਉਹ ਤਾਂ ਭਾਅ ਜੀ ਤੁਸੀਂ ਨਵੇਂ ਬੱਸ ਸਟੈਂਡ ਹੀ ਜਾਇਓ ਪੁਰਾਣੇ ਬੱਸ ਸਟੈਂਡ ਤੁਸੀਂ ਤੰਗ ਹੋਵੋਗੇ ਨਾ ਪੁਰਾਣੇ ਬੱਸ ਸਟੈਂਡ ਤੋਂ ਫਿਰ ਨਵੇਂ ਬੱਸ ਸਟੈਂਡ ਨੂੰ ਹੀ ਆਉਣੀ ਹੈ ਬੱਸ ਹਾਂਜੀ ਨਾਲੇ ਤੁਸੀਂ ਨਵੇਂ ਬੱਸ ਸਟੈਂਡ ਪਹੁੰਚ ਕੇ ਟਾਈਮ ਸਿਰ ਤਾਂ ਪਹੁੰਚ ਜਾਓਗੇ ਨਾਲੇ ਤੁਹਾਡੀ ਟੋਕ ਟਰੈਫਿਕ ਕੱਟੀ ਜਾਊਗੀ ਓ ਹਾਂਜੀ ਹਾਂਜੀ ਹਾਂਜੀ ਬੜੇ ਆਰਾਮ ਨਾਲ ਹਾਂਜੀ ਹਾਂਜੀ ਯੂਨੀਵਸਟੀ ਘੰਟਾ ਲੱਗ ਜਾਣਾ ਉਹ ਤਾਂ ਫਿਰ ਤੁਸੀਂ ਭਾਅ ਜੀ ਦੇਖੋ ਆਪਣਾ ਵਹੀਕਲ ਲੈ ਆਇਓ ਤੁਸੀਂ ਜਾਂ ਛੁੱਟੀ ਮਾਰ ਲਿਓ ਇਹ ਹੀ ਹੋ ਸਕਦਾ ਸਾਰੇ ਜਾਣੇ ਇਕੱਠੇ ਰਲ ਕੇ ਉਹ ਕਰਵਾ ਲਿਓ ਮਾਸ ਬੰਕ ਹਾਂਜੀ ਹਾਂਜੀ ਹਾਂਜੀ ਠੀਕ ਹੈ